ਮੇਰੀ ਮਨਪਸੰਦ ਦੌੜ ਤਾਂ ਰੀਲੇਅ ਹੈ ਕਿਉਂਕਿ ਉਸ ਵਿੱਚ ਬਹੁਤ ਮਜ਼ਾ ਆਉਂਦਾ ਹੈ ਕਿ ਚਾਰ ਜਣੇ ਅਸੀਂ ਪੇਅਰ 'ਚ ਹੁੰਦੇ ਹਾਂ ਪਾਟਨਰ ਨੂੰ ਭੱਜ ਕੇ ਅਸੀਂ ਬੈਟਨ ਫੜਾਉਂਦੇ ਹਾਂ ਅਤੇ ਫਿਰ ਉਹ ਅਗਲੇ ਨੂੰ ਫੜਾਉਂਦਾ ਇਸ ਵਿੱਚ ਬਹੁਤ ਮਜ਼ਾ ਆਉਂਦਾ ਹੈ ਅਤੇ ਮੇਰਾ ਇੱਕ ਰੋਮਾਂਚਕ ਦਿਲਚਸਪੀ ਦੀ ਇੱਕ ਘਟਨਾ ਵੀ ਜੁੜੀ ਹੋਈ ਹੈ ਦੌੜਾਂ ਨਾਲ ਸੰਬੰਧਿਤ ਪਹਿਲੀ ਵਾਰ ਜਦੋਂ ਮੈਂ ਫਸਟ ਟਾਈਮ ਇੰਟਰ ਕੋਲੇਜ ਖੇਡਣ ਗਈ ਸੀ ਤਾਂ ਫਸਟ ਜਦੋਂ ਹੀਟ ਸਟਾਟ ਹੁੰਦੀ ਹੈ ਤਾਂ ਮੈਨੂੰ ਨਹੀਂ ਪਤਾ ਸੀਗਾ ਮੈਂ ਫਾਊਲ ਕਰ ਤਾ ਸੀਗਾ ਅਤੇ ਉਸ ਟਾਈਮ ਫਾਊਲ ਕਰਕੇ ਥੋੜ੍ਹਾ ਨਰਵਸ ਵੀ ਫੀਲ ਹੋਇਆ ਸੀ ਫਸਟ ਲੇਕਿਨ ਪਹਿਲੀ ਟਾਈਮ ਸੀ ਉਨ੍ਹਾਂ ਨੇ ਵਾਰਨਿੰਗ ਦਿੱਤੀ ਸੀ ਅਤੇ ਫਿਰ ਦੁਬਾਰਾ ਵੀ ਕੀਤਾ ਅਤੇ ਇੱਕ ਵਾਰੀ ਮੈਂ ਰੇਸ ਕਰਦੇ ਹੋਏ ਡਿੱਗ ਵੀ ਗਈ ਅਤੇ ਫਿਰ ਉਹ ਵੀ ਇੱਕ ਹਾਸਾਪੂਰਨ ਰਿਹਾ ਮਸਤੀ ਵੀ ਕੀਤੀ ਅਸੀਂ ਇੰਟਰ ਕੋਲੇਜ ਖੇਡਣ ਅ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾ ਕੇ ਵੀ ਹਿੱਸਾ ਲਿਆ ਉੱਥੇ ਵੀ ਮਜ਼ਾ ਵੀ ਬਹੁਤ ਆਇਆ ਅਤੇ ਸਿੱਖਣ ਨੂੰ ਵੀ ਬਹੁਤ ਮਿਲਿਆ ਅਤੇ ਦੌੜਾਂ ਸਾਡੇ ਲਈ ਬਹੁਤ ਜ਼ਰੂਰੀ ਹਨ ਬੰਦਾ ਸਿਹਤਮੰਦ ਰਹਿੰਦਾ ਹੈ ਆਪਣੇ ਆਪ ਨੂੰ ਸਵੱਸਥ ਰੱਖਣਾ ਸਭ ਤੋਂ ਵੱਡਾ ਪਹਿਲੂ ਹੈ ਜੇ ਅਸੀਂ ਆਪ ਸਵੱਸਥ ਹਾਂ ਤਾਂ ਅਸੀਂ ਕੋਈ ਵੀ ਕੰਮ ਕਰ ਸਕਦੇ ਹਾਂ ਸਾਨੂੰ ਸਭ ਨੂੰ ਸੁਬਾਹ ਸੁਬਾਹ ਉੱਠ ਕੇ ਰਨਿੰਗ ਜੋਗਿੰਗ ਕਰਨੀ ਚਾਹੀਦੀ ਹੈ ਸਾਡਾ ਸਿਹਤ ਤੋਂ ਵੱਧ ਕੇ ਕੋਈ ਵੀ ਜ਼ਰੂਰੀ ਕੰਮ ਨਹੀਂ ਹੈ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਤਕਨੀਕੀ ਯੁੱਗ ਆ ਗਿਆ ਹੈ ਜਿਸ ਕਰਕੇ ਸਾਰੇ ਹੀ ਆਪਣੇ ਘਰਾਂ ਵਿੱਚ ਹ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ ਉਨ੍ਹਾਂ ਨੂੰ ਕੋਈ ਵਿਹਲ ਨਹੀਂ ਮਿਲਦੀ ਹੈ ਕੋਈ ਕਿਸੇ ਕੰਮ ਲਈ ਸਮਾਂ ਨਹੀਂ ਮਿਲ ਪਾਉਂਦਾ ਹੈ ਨਾ ਉਸਨੂੰ ਤੁਰਨ ਫਿਰਨ ਦਾ ਵੀ ਟਾਈਮ ਨਹੀਂ ਹੁੰਦਾ ਹੈ ਅੱਜ ਕੱਲ੍ਹ ਸਭ ਕੋਲ ਕਾਰਾਂ ਗੱਡੀਆਂ ਆ ਚੁੱਕੀਆਂ ਹਨ ਜਿਸ ਕਰਕੇ ਬੰਦਾ ਜਰਾ ਸਾ ਵੀ ਤੁਰਨਾ ਪਸੰਦ ਨਹੀਂ ਕਰਦਾ ਹੈ ਅਤੇ ਇਹ ਬਹੁਤ ਹੀ ਗਲਤ ਗੱਲ ਹੈ ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਦੌੜਾਂ ਲਗਾਈਏ ਹਲਕੀ ਹਲਕੀ ਜੋਗਿੰਗ ਕਰੀਏ ਬਜ਼ੁਰਗਾਂ ਨੂੰ ਵੀ ਸਵੇਰੇ ਤੋਰਾ ਫੇਰਾ ਕਰਨਾ ਚਾਹੀਦਾ ਹੈ ਰੋਜ਼ ਨਿੱਤ ਸੈਰ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਹੈ ਕਿਤੇ ਨੇੜੇ ਪਾਰਕ ਵਿੱਚ ਜਾਓ ਅਤੇ ਉਨ੍ਹਾਂ ਨਾਲ ਮਸਤੀ ਕਰੋ ਬੱਚਿਆਂ ਨਾਲ ਵੀ ਟਾਈਮ ਸਪੈਂਡ ਕਰਨਾ ਚਾਹੀਦਾ ਅੱਜ ਕੱਲ੍ਹ ਦੇ ਪੇਰੈਂਟਸ ਵੀ ਆਪਣੇ ਆਪ ਕੰਮਾਂ ਵਿੱਚ ਹੀ ਰੁੱਝੇ ਰਹਿੰਦੇ ਹਨ ਜਿਸ ਕਰਕੇ ਉਹ ਬੱਚਿਆਂ ਦਾ ਕੋਈ ਧਿਆਨ ਨਹੀਂ ਦਿੰਦੇ ਅਤੇ ਬੱਚੇ ਵੀ ਸਾਰਾ ਦਿਨ ਫੋਨਾਂ ਵਿੱਚ ਲੱਗੇ ਰਹਿੰਦੇ ਹਨ ਅਤੇ ਫੋਨ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਵੀ ਗਰਾਊਂਡ ਸਰੀਰਿਕ ਅਹ ਐਕਟੀਵਿਟੀ ਨਹੀਂ ਕਰਦੇ ਉਹ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਸ ਲਈ ਮੈਂ ਕਹਿਣਾ ਚਾਹੁੰਦੀ ਹਾਂ ਕਿ ਖੇਡਾਂ ਨੂੰ ਪਰਮੋਟ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਬਜ਼ੁਰਗ ਜਿਹੜੇ ਆਪਣੇ ਆਪਾਂ ਬਜ਼ੁਰਗਾਂ ਨੂੰ ਦੇਖਦੇ ਹੀ ਹਾਂ ਕਿ ਉਹ ਕਿੰਨੇ ਸਿਹਤਮੰਦ ਰਹਿੰਦੇ ਨੇ ਕਿੰਨੀ ਕਿੰਨੀ ਉਮਰਾਂ ਤੱਕ ਜਿਉਂਦੇ ਰਹਿ ਜਾਂਦੇ ਨੇ ਪੁਰਾਣੇ ਬਜ਼ੁਰਗ ਅਤੇ ਹੁਣ ਅੱਜ ਕੱਲ੍ਹ ਦੇ ਸੱਠ ਸੱਤਰ ਦੀ ਉਮਰ ਦੇ ਵਿੱਚ ਹੀ ਦਿਹਾਂਤ ਹੋਣ ਲੱਗ ਗਏ ਹਨ ਆਪਾਂ ਦੇਖਦੇ ਹੀ ਆ ਰਹੇ ਹਾਂ ਜਿਵੇਂ ਕਈ ਛੋਟੀ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਕਿਵੇਂ ਰੋ ਕਿੰਨੇ ਭਿਆਨਕ ਰੋਗ ਲੱਗ ਜਾਂਦੇ ਹਨ ਅਤੇ ਉਹ ਆਪਣਾ ਛੋਟੀ ਜਿਹੀ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ ਇਸ ਲਈ ਮੈਂ ਕਹਿਣਾ ਚਾਹੁੰਨੀ ਹਾਂ ਕਿ ਦੌੜ ਬਹੁਤ ਇੱਕ ਤਾਂ ਮਜ਼ੇਦਾਰ ਤਰੀਕੇ ਚੀਜ਼ ਹੈ ਜਿਸ ਨੂੰ ਆਪਾਂ ਮਨੋਰੰਜਨ ਨਾਲ ਵੀ ਕਰ ਸਕਦੇ ਹਾਂ ਅਤੇ ਆਪਣੇ ਆਪ ਨੂੰ ਸਵੱਸਥ ਵੀ ਰੱਖ ਸਕਦੇ ਹਾਂ ਧੰਨਵਾਦ